ਨੌਜਵਾਨਾਂ ਨੂੰ ਅੱਜ ਕੱਲ੍ਹ ਪਸ਼ੂਆਂ ਨੂੰ ਬਹੁਤ ਹੀ ਅਣਦੇਖਾ ਕਰ ਰਹੇ ਹਨ ਪਸ਼ੂਆਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਅਵਾਰਾ ਪਸ਼ੂ ਜਿਵੇਂ ਕਿ ਗਾਈਆਂ ਢੱਠੇ ਅੱਜ ਕੱਲ੍ਹ ਅਸੀਂ ਦੇਖਦੇ ਹੀ ਹਾਂ ਕਿ ਬਿਮਾਰ ਰਹਿੰਦੇ ਹਨ ਮੀਂਹ ਦੇ ਬਾਰਿਸ਼ ਦੇ ਵਿੱਚ ਅੱਜ ਕੱਲ੍ਹ ਉਹਨਾਂ ਨੂੰ ਕੀੜੇ ਪੈ ਜਾਂਦੇ ਹਨ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਜੋ ਨੌਜਵਾਨ ਉਹਨਾਂ ਦੀ ਦੇਖਭਾਲ ਕਰਨ ਅਤੇ ਉਹਨਾਂ ਦਾ ਸਫਾਈ ਰੱਖਣ ਉਹਨਾਂ ਨੂੰ ਕੱਖ ਕੰਡਾ ਸੁਬਹਾ ਸ਼ਾਮ ਅਤੇ ਰੋਟੀਆਂ ਪਾਉਣ ਵਧੀਆ ਉਹਨਾਂ ਨੂੰ ਸੇਵਾ ਮੁਹੱਈਆ ਕਰਵਾਉਣ ਉਹਨਾਂ ਦੇ ਟੈਮ ਟੂ ਟੈਮ ਇੰਜੈਕਸ਼ਨ ਲਗਾਏ ਜਾਣ ਜਿਵੇਂ ਕਿ ਗਾਂ ਨੂੰ ਸਾਨੂੰ ਘਰ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦਾ ਦੁੱਧ ਪੀ ਕੇ ਅਸੀਂ ਬਿਮਾਰੀਆਂ ਤੋਂ ਮੁਕਤ ਹੋਈਏ ਅਤੇ ਸਾਨੂੰ ਹੋਰ ਵੀ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਗਾਈਆਂ ਰੱਖੋ ਅਤੇ ਬਿਮਾਰੀਆਂ ਤੋਂ ਮੁਕਤ ਹੋਵੋ ਗਾਂ ਦਾ ਦੁੱਧ ਬਹੁਤ ਹੀ ਲਾਭਦਾਇਕ ਹੈ ਸਾਡੇ ਸਰੀਰ ਲਈ ਸਾਡੀ ਤੰਦਰੁਸਤੀ ਲਈ ਗਾਂ ਦਾ ਦੁੱਧ ਬੱਚਿਆਂ ਲਈ ਵੀ ਬਹੁਤ ਵਧੀਆ ਗੁਣਕਾਰੀ ਹੈ ਜਿਵੇਂ ਕਿ ਕੋਈ ਬੱਚਾ ਦੁੱਧ ਨਹੀਂ ਪੀਂਦਾ ਤਾਂ ਉਹਨੂੰ ਗਾਂ ਦਾ ਦੁੱਧ ਪਿਆਇਆ ਜਾਂਦਾ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਮੁਕਤ ਹੋ ਸਕੇ ਅਤੇ ਨਾਲ ਹੀ ਨਾਲ ਗਾਈਂ ਦਾ ਘਿਓ ਰੋਟੀ ਵਿੱਚ ਸਬਜ਼ੀ ਵਿੱਚ ਪਾ ਕੇ ਸਾਨੂੰ ਖਾਣਾ ਚਾਹੀਦਾ ਹੈ ਤਾਂ ਜੋ ਅਸੀਂ ਸਰੀਰ ਨੂੰ ਤੰਦਰੁਸਤ ਬਣਾਈਏ ਖੇਡਣ ਦੇ ਜੀਵਨ ਵਿੱਚ ਸਾਨੂੰ ਘਿਓ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਜੋ ਅਸੀਂ ਗਾਂ ਘਰ ਰੱਖ ਕੇ ਉਸ ਦਾ ਦੁੱਧ ਘਿਓ ਮੱਖਣ ਖਾ ਸਕੀਏ ਤਾਂ ਸਰੀਰ ਨੂੰ ਅਸੀਂ ਇੱਕ ਵਧੀਆ ਮੁਕਾਮ 'ਤੇ ਲਿਆ ਸਕੀਏ ਗਾਈਆਂ ਮੱਝਾਂ ਸਾਨੂੰ ਹਰ ਰੋਜ਼ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਨਾਲ ਸਾਨੂੰ ਘਰ ਵਿੱਚ ਅਤੇ ਬਾਹਰਲੇ ਪਸ਼ੂਆਂ ਨੂੰ ਵੀ ਸਾਨੂੰ ਦੇਖਣਾ ਚਾਹੀਦਾ ਹੈ ਉਹਨਾਂ ਨੂੰ ਟੈਮ ਟੂ ਟੈਮ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਚਿੱਚੜ ਬੁਖਾਰ ਆਦਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਸਾਨੂੰ ਉਹਨਾਂ ਨੂੰ ਹਰ ਰੋਜ਼ ਸਵੇਰੇ ਸ਼ਾਮ ਕੱਖ ਖਲ ਫੀਡ ਆਦਿ ਪਾਈਏ ਤਾਂ ਜੋ ਉਹ ਦੁੱਧ ਵੱਧ ਤੋਂ ਵੱਧ ਦੇ ਸਕਣ ਉਹਨਾਂ ਨੂੰ ਸਾਨੂੰ ਟਾਈਮ 'ਚੋਂ ਟਾਈਮ ਕੱਢ ਕੇ ਉਹਨਾਂ ਨੂੰ ਨਵਾਈਏ ਵੱਧ ਤੋਂ ਵੱਧ ਹਰਾ ਚਾਰਾ ਅਤੇ ਉਹਨਾਂ ਦੀ ਸਫਾਈ ਰੱਖੀਏ ਫਰਸ਼ ਦੀ ਸਫਾਈ ਰੱਖੀਏ ਤਾਂ ਜੋ ਉਹਨਾਂ ਦੇ ਚਿੱਚੜੀਆਂ ਵਗੈਰਾ ਨਾ ਲੱਗਣ ਪਸ਼ੂਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਰੱਖਿਆ ਰੱਖਣਾ ਚਾਹੀਦਾ ਹੈ ਅਤੇ ਮੇਰੇ ਕੋਲ ਵੀ ਇੱਕ ਗਾਂ ਹੈ ਜਿਸ ਨੂੰ ਮੈਂ ਬਹੁਤ ਹੀ ਵਧੀਆ ਢੰਗ ਨਾਲ ਰੱਖ ਰਿਹਾ ਹਾਂ ਉਹਨੂੰ ਵਧੀਆ ਦੁੱਧ ਦੇ ਰਹੀ ਹੈ ਟੈਮ ਟੂ ਟੈਮ ਕੱਖ ਕੰਡਾ ਅਤੇ ਨਾਲ ਦੀ ਨਾਲ ਉਹਨੂੰ ਦੁੱਧ ਪ੍ਰਾਪਤ ਕਰਕੇ ਮੈਂ ਬਹੁਤ ਹੀ ਪੈਸਾ ਕਮਾ ਰਿਹਾ ਹਾਂ